ਜੇ ਆਪਾਂ ਪੰਜਾਬ ਨੂੰ ਦੇਖੀਏ ਤਾਂ ਵੱਡੇ ਤੌਰ 'ਤੇ ਆਪਾਂ ਪੰਜਾਬ ਨੂੰ ਤਿੰਨ ਹਿੱਸਿਆਂ 'ਚ ਵੰਡ ਸਕਦੇ ਹਾਂ ਮਾਝਾ ਮਾਲਵਾ ਅਤੇ ਦੁਆਬਾ ਅਤੇ ਉਹ ਭਾਸ਼ਾਵਾਂ ਜੇ ਆਪਾਂ ਵੇਖੀਏ ਤਾਂ ਇੱਕ ਵੱਡੀ ਪੱਧਰ 'ਤੇ ਜਿਹੜੀ ਪੰਜਾਬੀ ਬੋਲੀ ਜਾਂਦੀ ਏ ਉਹ ਹਰ ਖੇਤਰ ਦੇ ਵਿੱਚ ਪੰਜਾਬੀ ਹੀ ਬੋਲੀ ਜਾਂਦੀ ਏ ਅਤੇ ਉਹਦੇ ਵਿੱਚ ਅੱਖਰਾਂ ਦਾ ਅਤੇ ਉਹਨਾਂ ਨੂੰ ਬੋਲਣ ਦਾ ਜਿਹੜਾ ਤਰੀਕਾ ਉਹਦਾ ਸਬੱਬ ਏ ਉਹ ਥੋੜ੍ਹਾ ਅੱਡ ਏ ਪਰ ਉਸ ਨੂੰ ਉਪਭਾਸ਼ਾ ਦੀ ਉਪਮਾ ਦੇਣਾ ਠੀਕ ਨਹੀਂ ਹੋਵੇਗਾ ਕਿਉਂਕਿ ਭੂਗੋਲ ਦੇ ਹਿਸਾਬ ਨਾਲ ਜਿਸ ਤਰੀਕੇ ਨਾਲ ਉੱਥੇ ਦੀ ਜੋਗਰਫੀ ਸੀ ਜਿਸ ਤਰੀਕੇ ਨਾਲ ਉਹਨਾਂ ਦੇ ਕਲਚਰ ਲਈ ਉਹ ਡ ਡਿਵੈਲਪ ਹੋਈ ਉਹ ਅੱਗੇ ਵਧੇ ਉਸ ਤਰੀਕੇ ਨਾਲ ਸ਼ਬਦਾਂ ਨੂੰ ਬੋਲਣ ਦਾ ਅਤੇ ਕਹਿਣ ਦਾ ਤਰੀਕਾ ਥੋੜ੍ਹਾ ਅੱਡ ਹੁੰਦਾ ਗਿਆ ਪਰ ਵੱਡੇ ਪੱਧਰ 'ਤੇ ਅਤੇ ਮੁੱਖ ਤੌਰ 'ਤੇ ਜੇ ਆਪਾਂ ਦੇਖੀਏ ਤਾਂ ਖਲੀ ਬੋਲਣ ਨੂੰ ਜੇ ਸ਼ਬਦਾਂ ਦਾ ਅਲਫਾਜ਼ ਜਿਹੜਾ ਵਰਤਣ ਦਾ ਤਰੀਕਾ ਉਹ ਥੋੜ੍ਹਾ ਅੱਡਾ ਹੈ ਪਰ ਉਹ ਸਮਝ 'ਚ ਉਹਨੂੰ ਆਪਾਂ ਸਮਝ ਸਕਦੇ ਆ ਪਰ ਜੇ ਪੰਜਾਬ ਦੇ ਮਾਲਵਾ ਛੇਤਰ ਦੇ ਵਿੱਚ ਦੇਖੀਏ ਤਾਂ ਕੁਝ ਇੰਟਰਸਟੇਟ ਜੇ ਆਪਾਂ ਬਾਰਡਰ ਹੈ ਜਿਵੇਂ ਉਹ ਤਿੰਨ ਰਾਜਿਆਂ ਦੇ ਬਾਰਡਰ 'ਤੇ ਮਾਲਵਾ ਲੱਗਦਾ ਹੈ ਇੱਕ ਪਾ ਇੱਕ ਮਾਝੀ ਇੱਕ ਪਾਸੇ ਹਰਿਆਣਾ ਅਤੇ ਇੱਕ ਬੰਨੇ ਰਾਜਸਥਾਨ ਲੱਗਦਾ ਹੈ ਅਤੇ ਉੱਥੇ ਕੁਛ ਆਲੇ ਦੁਆਲੇ ਕੁਝ ਇਹੋ ਜਿਹੇ ਪਿੰਡ ਨੇ ਅਤੇ ਜਿਹੜੇ ਹਰਿਆਣੇ ਦੇ ਵੀ ਜਿਹੜੇ ਲਾਗੇ ਦੇ ਬਾਰਡਰ ਦੇ ਪਿੰਡ ਨੇ ਜਿਹੜੇ ਜੋ ਸਮਾਨਤ ਹੈ ਉਹ ਵੀ ਪੰਜਾਬੀ ਦਾ ਇਸਤੇਮਾਲ ਕਰਦੇ ਆ ਪਰ ਉਹਨਾਂ ਦੇ ਬੋਲਣ ਦਾ ਤਰੀਕਾ ਥੋੜ੍ਹਾ ਵੱਖਰਾ ਹੈ ਅਤੇ ਕੁਛ ਇਹੋ ਜਿਹੇ ਪਿੰਡ ਇਹੋ ਜਿਹੇ ਵੀ ਹੈ ਮਾਲਵਾ ਛੇਤਰ ਦੇ ਵਿੱਚ ਜਿਹੜੇ ਇੱਕ ਬਾਗੜੀ ਜੋ ਕਿ ਰਾਜਸਥਾਨੀ ਅਤੇ ਹਰਿਆਣੇ ਦਾ ਕੁਝ ਮਿਕਸ ਉਹ ਲੋਕ ਇਹੋ ਜਿਹੀ ਵਰਤੋਂ ਕਰਦੇ ਆ ਪਰ ਉਹਨਾਂ ਦੀ ਵੀ ਪੰਜਾਬੀ ਨੂੰ ਸਮਝਣ ਦਾ ਅਤੇ ਉਹ ਵੀ ਪੰਜਾਬੀ ਸਮਝਦੇ ਆ ਅਤੇ ਬੋਲਦੇ ਵੀ ਹੈ ਇਹਨਾਂ ਛੇਤਰਾਂ ਵਿੱਚ ਦੇਖਿਆ ਗਿਆ ਜਿਵੇਂ ਸਰਸੇ ਦੇ ਲਾਗੇ ਇੱਕ ਪਿੰਡ ਹੈ ਨਾਥੋਰ ਉੱਥੇ ਜਿਹੜੇ ਚੰਡੀਗੜ੍ਹ ਟ੍ਰਿਬਿਊਨ ਨਾਮ ਦਾ ਜਦੋਂ ਇੱਕ ਅਖਬਾਰ ਸੀ ਉੱਥੇ ਗਏ ਅਤੇ ਸਰਚ ਕੀਤੀ ਉੱਥੇ ਬੜਾ ਆਰਟੀਕਲ ਲਿਖਿਆ ਉੱਥੇ ਪੂਰਾ ਉਹ ਲੇਖ ਲਿਖਿਆ ਗਿਆ ਤਾਂ ਉਹਨਾਂ ਨੇ ਇੱਕ ਲੇਖ ਲਿਖਿਆ ਸੀ ਟਾਈਟਲ ਤੋਂ ਬਾਗੜੀ ਮਾਵਾਂ ਦੇ ਪੰਜਾਬੀ ਤਾਂ ਲਾਗੇ ਦੇ ਛੇਤਰਾਂ ਵਿੱਚ ਵੀ ਜਿਹੜੀ ਉਪਬੋਲੀਆਂ ਉਹਨਾਂ ਨੂੰ ਵੀ ਪੰਜਾਬੀ ਨੇ ਪ੍ਰਭਾਵਿਤ ਕੀਤਾ ਹੈ ਅਤੇ ਉਹਨਾਂ ਵੀ ਸ਼ਬਦਾਂ ਦਾ ਜੋੜ ਮਿਲਦਾ